ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਧਾਰ ਕਾਰਡ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਇੱਕ ਵਿਸ਼ੇਸ਼ ਪਛਾਣ ਕਾਰਡ ਹੈ ਜਿਸ ਵਿੱਚ ਬਾਰ੍ਹਾਂ ਅੰਕ ਦਾ ਇੱਕ ਵਿਕਲਪ ਨੰਬਰ ਹੁੰਦਾ ਹੈ ਆਧਾਰ ਕਾਰਡ ਹਰ ਨਾਗਰਿਕ ਦੀ ਜਨਮ ਤਰੀਕ ਪਤਾ ਅਤੇ ਬਾਇਓਮੈਟਰਿਕ ਜਾਣਕਾਰੀ ਨੂੰ ਦਰਸਾਉਂਦਾ ਹੈ ਆਧਾਰ ਕਾਰਡ ਨੂੰ ਬੈਂਕ ਅਤੇ ਖਾਤੇ ਨਾਲ ਜੋੜਨ ਅ ਨਾ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਹੋ ਗਿਆ ਹੈ ਕਿਉਂਕਿ ਇਹ ਕਈ ਸਰਕਾਰੀ ਨੌਜਵਾਨਾਂ ਦੇ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਸਰਕਾਰੀ ਸਹਾਇਤਾ ਦੇ ਵਿੱਚ ਬਹੁਤ ਮਦਦ ਕਰਦਾ ਹੈ ਭਾਰਤ ਸਰਕਾਰ ਦੀਆਂ ਕਈ ਯੋਜਨਾਵਾਂ ਜਿਵੇਂ ਕਿ ਪੀ ਐਮ ਕਿਸਾਨ ਉਜਵਲਾ ਯੋਜਨਾ ਮਨਰੇਗਾ ਅਤੇ ਆਦਿ 'ਤੇ ਤਹਿਤ ਮਿਲਣ ਵਾਲੇ ਲਾਭ ਅਧ ਅਧਾਰਿਤ ਲਿੰਕਡ ਖਾਤਿਆਂ ਵਿੱਚ ਸਿੱਧਾ ਜਮ੍ਹਾਂ ਕੀਤੇ ਜਾਂਦੇ ਹਨ ਆਰਥਿਕ ਸ਼ਮ ਸ਼ਾਮਲਾਤੀ ਵੀ ਇਹਦੇ ਵਿੱਚ ਹੀ ਕੀਤੀ ਜਾਂਦੀ ਹੈ ਬਹੁਤ ਸਾਰੇ ਲੋਕ ਜੋ ਪਹਿਲਾਂ ਬੈਂਕਿੰਗ ਸਿਸਟਮ ਤੋਂ ਦੂਰ ਸਨ ਹੁਣ ਆਧਾਰ ਕਾਰਡ ਲਿੰਕ ਕਰਨ ਦੇ ਨਾਲ ਹਨ ਜਨ ਧਨ ਖ ਖਾਤਿਆਂ ਰਾਹੀਂ ਬੈ ਬੈਂਕਿੰਗ ਦੀਆਂ ਸਹੂਲਤਾਂ ਦੀ ਵਰਤੋਂ ਕਰ ਰਹੇ ਹਨ ਕੇ ਵਾਏ ਸੀ ਵਾਲੀ ਕੇ ਵਾਏ ਸੀ ਦੀ ਸਕੀਮ ਵੀ ਤੁਸੀਂ ਆਪਣੀ ਕਰ ਸਕਦੇ ਹੋ ਠੋਕ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਆਧਾਰ ਨਾਲ ਬੈਂਕ ਖਾਤਾ ਜੋੜਨ ਲਈ ਨਾਲ ਨਕਲੀ ਅ ਖਾਤੇ ਖੋਲ੍ਹਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਸਰਕਾਰੀ ਯੋਜਨਾਵਾਂ ਦੇ ਗਲਤ ਇਸਤੇਮਾਲ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਪੈਨ ਕਾਰਡ ਅਤੇ ਆਧਾਰ ਨੂੰ ਜੋੜਨ ਲਈ ਨਾਲ ਟੈਕਸ ਵਿਸ ਵਿਵਸਥਾ ਵਿੱਚ ਸੁਧਾਰ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਟੈਕਸ ਰਿਟਾ ਰਿਟਾਰਨ ਫਾਈਲ ਕਰਨ ਦੀ ਪ੍ਰਕਿਰਿਆ ਨੂੰ ਵੀ ਆਸਾਨ ਬਣਾਉਂਦਾ ਹੈ ਆਧਾਰ ਕਾਰਡ ਨੂੰ ਬੈਂਕ ਨਾਲ ਜੋੜਨਾ ਅਨੁ ਅ ਆਧੁਨਿਕ ਭਾਰਤ ਦੀ ਇੱਕ ਬੁੱਧੀਮਾਨ ਚਾਲ ਹੈ ਜੋ ਕਿ ਆਮ ਨਾਗਰਿਕਾਂ ਦੇ ਸੁੱਖ ਸੁਵਿਧਾ ਅਤੇ ਆਰਥਿਕ ਸੁਵ ਭਲਾਈ ਵੱਲ ਇੱਕ ਵੱਡਾ ਕਦਮ ਹੈ ਸੋ ਮੈਂ ਅਖੀਰ ਵਿੱਚ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਹਾਨੂੰ ਵੀ ਆਪਣਾ ਆਧਾਰ ਕਾਰਡ ਸਬਸਿਡੀ ਲਾਭਾਂ ਵਾਸਤੇ ਆਪਣੇ ਬੈਂਕ ਖਾਤੇ ਦੇ ਨਾਲ ਜੋੜਨਾ ਚਾਹੀਦਾ ਹੈ ਅਤੇ ਮੈਂ ਦਰਸ਼ਕਤਾ ਦਰਸ਼ਕਾਂ ਨੂੰ ਇਹ ਤ ਇਹ ਸਲਾਹ ਮੰਗ ਰਹੀ ਮੰਗਣਾ ਚਾਹੁੰਦੀ ਹਾਂ ਕਿ ਇਹ ਪ੍ਰਕਿਰਿਆ ਨੂੰ ਕਿਵੇਂ ਪੂਰਾ ਕਰਾਂ ਮੈਂ ਬਹੁਤ ਜ਼ਿਆਦਾ ਇੱਕ ਟਾਈਮ 'ਤੇ ਇੱਧਰ ਉੱਧਰ ਹੋ ਜਾਂਦੀ ਹਾਂ ਵੀ ਮੈਂ ਆਪਣੇ ਮੇਰੇ ਕੋਲ ਦੋ ਬੈਂਕ ਅਕਾਊਂਟ ਹੈ ਅਤੇ ਮੈਂ ਕਿਹੜੇ ਵਾਲੇ ਬੈਂਕ ਅਕਾਊਂਟ ਨਾਲ ਉਹਨੂੰ ਲਿੰਕ ਕਰਾਂ ਅਤੇ ਕਿਹਦੇ ਨਾਲ ਜ਼ਿਆਦਾ ਲਾਭ ਹੋਣਗੇ ਇੱਕ ਮੇਰੇ ਕੋਲ ਆਰ ਸੈਂਟਰਲ ਬੈਂਕ ਦਾ ਵੀ ਖਾਤਾ ਹੈਗਾ ਅਤੇ ਇੱਕ ਮੇਰੇ ਕੋਲ ਪੰਜਾਬ ਬੈਂਕ ਦਾ ਖਾਤਾ ਵੀ ਹੈਗਾ ਅਤੇ ਕਿਰਪਾ ਕਰਕੇ ਸਾਰਿਆਂ ਨੂੰ ਨਿਵੇਦਨ ਹੈ ਕਿ ਕਮੈਂਟ ਬਾਕਸ ਵਿੱਚ ਦੱਸਿਆ ਜਾਵੇ ਕਿ ਤੁਸੀਂ ਕਿਹੜਾ ਵਿੱਚ ਮੈਨੂੰ ਸਲਾਹ ਦਊਂਗੇ ਕਰਨ ਵਾਸਤੇ ਅਤੇ ਇਹ ਸਾਰਾ ਸਭ ਕੁਛ ਪ੍ਰਕਿਰਿਆ ਕਿੱਥੋਂ ਕ ਕਿੱਥੋਂ ਅਤੇ ਕਿੱਦਾਂ ਕੀਤੀ ਜਾਂਦੀ ਹੈ ਕਿਰਪਾ ਕਰਕੇ ਸਾਰੇ ਮੈਨੂੰ ਅੱਜ ਦੱਸਣ ਤੇ ਤੋ ਮੈਂ ਵੀ ਬੈਂਕ ਦੇ ਖਾਤੇ ਦੇ ਨਾਲ ਜੋੜਨ ਵਾਲੇ ਲਾਭ ਪ੍ਰਾਪਤ ਕਰ ਸਕਾਂ ਧੰਨਵਾਦ